ਅਸੀਂ ਇੰਸਟਾਗ੍ਰਾਮ ਟਵੀਟਰ ਫੇਸਬੁੱਕ ਵਗੈਰਾ ਯੂਜ ਕਰਦੇ ਹਾਂ ਪਰ ਇਹਨਾਂ ਨੂੰ ਜ਼ਿਆਦਾ ਵੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਅੱਜ ਕੱਲ੍ਹ ਇਸ ਚੀਜ਼ 'ਤੇ ਪੰਜਾਬ ਦੇ ਉੱਤੇ ਇਸ ਚੀਜ਼ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਜੋ ਕੁਛ ਵੀ ਹੋ ਰਿਹਾ ਹੈ ਉਹ ਸਹੀ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੂੰ ਵੇਖ ਵੇਖ ਕੇ ਅੱਜ ਕੱਲ੍ਹ ਦੀ ਜਿਹੜੀ ਨਵੀਂ ਪੀੜੀ ਹੈ ਉਹ ਆਪਣੇ ਪੰਜਾਬ ਨੂੰ ਭੁੱਲਦੀ ਜਾ ਰਹੀ ਹੈ ਆਪਣੇ ਪੰਜਾਬ ਨੂੰ ਖੋ ਰਹੀ ਹੈ ਜਿਸ ਦੇ ਕਰਕੇ ਪੰਜਾਬ ਦੀ ਪੰਜਾਬੀਅਤ ਪਿੱਛੇ ਹੱਟ ਗਈ ਹੈ ਅਤੇ ਅਸੀਂ ਇਸਦੇ ਵਿੱਚ ਥੋੜ੍ਹਾ ਬਹੁਤਾ ਹੀ ਸਮਾਂ ਬਿਤਾਉਂਦੇ ਹਾਂ ਜਿਸਦੇ ਕਰਕੇ ਥੋੜ੍ਹਾ ਬਹੁਤਾ ਪੋਲੀਟਿਕਸ ਦੇ ਬਾਰੇ ਗਿਆਨ ਮਿਲ ਜਾਂਦਾ ਕਿ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿੱਥੇ ਹੋ ਰਿਹਾ ਕਿਸ ਕਿਸ ਕਿਸ ਚੀਜ਼ ਦੇ ਬਾਰੇ ਸਭ ਚੀਜ਼ਾਂ ਦਾ ਤੁਹਾਨੂੰ ਤਕਰੀਬਨ ਇਸ 'ਤੇ ਅਪਡੇਟ ਰਹਿੰਦਾ ਹੈ ਇਸ ਦਾ ਚਲੋ ਇਹ ਤਾਂ ਫਾਇਦਾ ਹੈ ਪਰ ਇਸ ਨੂੰ ਜ਼ਿਆਦਾ ਪਸੰਦ ਇਸ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਦੇ ਉੱਤੇ ਜ਼ਿਆਦਾਤਰ ਅੱਜ ਕੱਲ੍ਹ ਲੱਚਰਤਾ ਫੈਲ ਰਹੀ ਹੈ ਜਿਸਦੇ ਕਰਕੇ ਅੱਜ ਕੱਲ ਦੀ ਪੀੜੀ ਕੁਛ ਜ਼ਿਆਦਾ ਹੀ ਗਲਤ ਰਸਤੇ ਦੇ ਵੱਲ ਜਾ ਰਹੀ ਹੈ ਇਸ ਦੇ ਵਿੱਚ ਕੁਝ ਕੁਝ ਚੀਜ਼ਾਂ ਚੰਗੀਆਂ ਨੇ ਕੁਝ ਕੁਝ ਚੀਜ਼ਾਂ ਜ਼ਿਆਦਾ ਗਲਤ ਨੇ ਜਿਨ੍ਹਾਂ ਨੂੰ ਅਸੀਂ ਗਿਆਨ ਦੇ ਮੁੱਦੇ 'ਤੇ ਰੱਖਦੇ ਹੋਏ ਇਹੀ ਚੀਜ਼ ਕਹਿੰਦੇ ਹਾਂ ਕਿ ਆਪਣੀ ਪੰਜਾਬ ਦੀ ਪੰਜਾਬੀਅਤ ਨੂੰ ਨਾ ਛੱਡੋ ਪਲੀਜ਼ ਉਸ ਦਾ ਸਾਥ ਨਾ ਛੱਡੋ ਉਸਦੇ ਨਾਲ ਰਹੋ ਇਹ ਚੀਜ਼ਾਂ ਇੱਕ ਸਿਰਫ ਲੋਕਾਂ ਦਾ ਧਿਆਨ ਅਟ੍ਰੈਕਸ਼ਨ ਕਰਨ ਦੇ ਲਈ ਰੱਖੀਆਂ ਗਈਆਂ ਹਨ ਜਿਸਦੇ ਨਾਲ ਹਰ ਇੱਕ ਪਰਸਨ ਆਪਣੇ ਮੇਨ ਅਹੁਦੇ ਤੋਂ ਮੇਨ ਕੰਮ ਦੇ ਵੱਲ ਉਸਦਾ ਰੁਝਾਨ ਘੱਟਦਾ ਜਾ ਰਿਹਾ ਹੈ ਜਿਸਦੇ ਕਰਕੇ ਉਹ ਅੱਜ ਕੱਲ੍ਹ ਫੋਨ ਦੇ ਹੀ ਵਿੱਚ ਹੀ ਵੜੇ ਰਹਿੰਦੇ ਹਨ ਜਿਸਦੇ ਕਰਕੇ ਉਹ ਅੱਜ ਕੱਲ੍ਹ ਇਹਨਾਂ ਦੇ ਨਾਲ ਅੱਜ ਕੱਲ੍ਹ ਰਿਸ਼ਤੇਦਾਰੀਆਂ ਖਤਮ ਹੋ ਗਈਆਂ ਰਿਸ਼ਤੇਦਾਰੀਆਂ ਘੱਟ ਗਈਆਂ ਬਹੁਤ ਕਿਉਂਕਿ ਲੋਕ ਅੱਜ ਕੱਲ੍ਹ ਇੱਕ ਦੂਜੇ ਨੂੰ ਮਿਲਣ ਵੀ ਨਹੀਂ ਆਉਂਦੇ ਫੋਨ ਦੇ ਕਰਕੇ ਇਹ ਚੀਜ਼ਾਂ ਦੇ ਕਰਕੇ ਲੋਕ ਇਹਨਾਂ ਦੇ ਨਾਲ ਹੀ ਵੜੇ ਇਹਨਾਂ ਦੇ ਵਿੱਚ ਹੀ ਵੜੇ ਰਹਿੰਦੇ ਹਨ